ਪਾਣੀ ਸਾਡੇ ਖੇਤਰਾਂ ਵਿੱਚ ਕਿਹੜੇ ਕੁਦਰਤੀ ਸਰੋਤ ਹਨ ਪਾਣੀ ਸਾਡੀ ਖੇਤੀਬਾੜੀ ਵਿੱਚ ਵਰਤਿਆ ਜਾਂਦਾ ਹੈ ਜਾਂ ਅਸੀਂ ਦਰੱਖਤਾਂ ਵਾਸਤੇ ਵਰਤਦੇ ਹਾਂ ਆਪਣੇ ਲੋਕਾਂ ਵਾਸਤੇ ਪਾਣੀ ਵਰਤਿਆ ਜਾਂਦਾ ਹੈ ਲੱਕੜੀ ਜਿਵੇਂ ਫਰਨੀਚਰ ਬਣਾਉਣ ਦੇ ਕੰਮ ਆਉਂਦੀ ਹੈ ਬਾਲਣ ਬਣਾਉਣ ਦੇ ਵਿੱਚ ਵਰਤੀ ਜਾਂਦੀ ਹੈ ਲੱਕੜੀ ਜਾਂ ਦਰਵਾਜੇ ਖਿੜਕੀਆਂ ਬਣਾਉਣ ਦੇ ਵਿੱਚ ਵਰਤੀ ਜਾਂਦੀ ਹੈ ਅਸੀਂ ਦਵਾਈਆਂ ਵਾਲੇ ਪੌਦੇ ਜਿਵੇਂ ਅਸੀਂ ਦਵਾਈਆਂ ਵਾਲੇ ਪੌਦੇ ਵੀ ਲਗਾਉਂਦੇ ਹਾਂ ਜਿਵੇਂ ਜੜੀ ਬੂਟੀਆਂ ਜੋ ਅਸੀਂ ਦਵਾਈ ਬਣਾਉਣ ਦੇ ਵਿੱਚ ਵਰਤਦੇ ਹਾਂ ਰੇਤ ਮਕਾਨ ਬਣਾਉਣ ਦੇ ਕੰਮ ਰੇਤ ਵਰਤੀ ਜਾਂਦੀ ਹੈ ਮਕਾਨ ਬਣਾਉਣ ਦੇ ਕੰਮ ਵਿੱਚ ਰੇਤ ਵਰਤੀ ਜਾਂਦੀ ਹੈ ਜਿਵੇਂ ਕਿ ਮਿੱਟੀ ਮਿੱਟੀ ਆਪਾਂ ਮਿੱਟੀ ਇੱਟਾਂ ਬਣਾਉਣ ਦੇ ਵਾਸਤੇ ਵਰਤੀ ਜਾਂਦੀ ਹੈ ਜਿਸ ਵਿੱਚ ਅਸੀਂ ਇੱਟਾਂ ਬਣਾ ਕੇ ਮਿੱਟੀ ਦੀਆਂ ਇੱਟਾਂ ਬਣਾ ਕੇ ਮਕਾਨ ਬਣਾਉਣ ਦੇ ਵਿੱਚ ਇੱਟਾਂ ਦੀ ਵਰਤੋਂ ਹੁੰਦੀ ਹੈ